ਨਮਸਕਾਰ ਜੀ ਮੈਂ ਨਰੇਸ਼ ਕੁਮਾਰ ਬੋਲ ਰਿਹਾ ਜੀ ਜਿੱਦਾਂ ਹੁਣ ਕਿ ਅਸੀਂ ਪੰਜਾਬ ਖੇਡਾਂ ਜਾਂ ਇੰਟਰਨੈਸ਼ਨਲ ਖੇਡਾਂ ਦੇ ਵਿੱਚ ਖਿਡਾਰੀ ਖੇਡਦਾ ਹੈ ਅਤੇ ਐਮਰਜੰਸੀ ਜਿੱਦਾਂ ਉਹਦੇ ਚੋਟ ਲੱਗ ਜਾਂਦੀ ਹੈ ਕਿਸੇ ਵੇਲੇ ਵੀ ਹਾਦਸਾ ਹੋ ਜਾਂਦਾ ਹੈ ਹਾਦਸੇ ਦੇ ਵਿੱਚ ਉਹਨੂੰ ਪਹਿਲਾਂ ਤਾਂ ਫਸਟ ਐਡ ਦੇਣ ਦੀ ਕੀਤੀ ਜਾਂਦੀ ਹੈ ਕਿ ਉਹ ਠੀਕ ਹੋ ਜਾਏ ਫਸਟ ਐਡ ਦੇ ਵਿੱਚ ਉਹਦਾ ਇਲਾਜ ਕੀਤਾ ਜਾਂਦਾ ਆ ਫਸਟ ਐਡ ਸੀ ਇਲਾਜ ਨਾ ਹੋਵੇ ਉਹਦੀ ਰੋਕਥਾਮ ਨਾ ਹੋਵੇ ਫਿਰ ਉਹਨੂੰ ਰੈਸਟ ਵਾਸਤੇ ਬਾਹਰ ਭੇਜਿਆ ਜਾਂਦਾ ਕਿ ਇਸ ਦੀ ਜਗ੍ਹਾ ਸਬਸੀਟਿਊਡ ਕੋਈ ਹੋਰ ਪਲੇਅਰ ਜਾਂ ਲਿਆ ਜਾਂਦਾ ਅੰਦਰ ਉਹਨੂੰ ਰੈਸਟ ਦਿੱਤੀ ਜਾਂਦੀ ਹੈ ਜਿੱਦਾਂ ਅੱਧਾ ਘੰਟਾ ਹੋ ਗਿਆ ਪੰਦਰਾਂ ਮਿੰਟ ਹੋ ਗਏ ਜਿਸ ਹਿਸਾਬ ਨਾਲ ਵੀ ਜਿਸ ਨਾਲ ਉਹ ਠੀਕ ਹੋ ਜਾਂਦਾ ਹੈ ਅਤੇ ਦੁਬਾਰਾ ਮਤਲਬ ਕੀ ਆ ਸਕਦਾ ਹੈ ਫਸਟ ਐਡ ਨੇ ਕਿ ਵੀ ਆਇਸ ਥੈਰੇਪੀ ਦਿੰਦੇ ਹਾਂ ਅਸੀਂ ਜਾਂ ਹੀਟ ਵਗੈਰਾ ਦਿੰਦੇ ਹਾਂ ਕਿ ਜਿਸ ਤਰ੍ਹਾਂ ਦੀ ਸੱਟ ਹੋਵੇ ਉਸ ਹਿਸਾਬ ਨਾਲ ਰੋਕਥਾਮ ਲਈ ਉਹਦੀ ਪਲੇਅਰ ਠੀਕ ਹੋ ਜਾਏ ਜਾਂ ਉਹਨੂੰ ਉਹ ਸੁੰਨ ਕਰਨ ਵਾਲੀ ਦਵਾਈ ਲਗਵਾ ਦਿੰਦੇ ਹਾਂ ਕਿ ਸੁੰਨ ਹੋ ਜੇ ਸਰੀਰ ਵੀ ਉਹਨੂੰ ਪਤਾ ਨਾ ਲੱਗੇ ਕਿ ਮੇਰੇ ਚੋਟ ਦਰਦ ਹੋ ਰਹੀ ਹੈ ਜਾਂ ਫਿਰ ਉਸ ਦਾ ਇਲਾਜ ਜਿੱਦਾਂ ਮਤਲਬ ਕਿ ਬਾਅਦ 'ਚੋਂ ਖੇਡ ਖੇਡਣ ਵੇਲੇ ਤਾਂ ਉਹ ਖੇਡ ਲਏਗਾ ਉਸ ਤੋਂ ਬਾਅਦ ਉਹਦਾ ਇਲਾਜ ਕੀਤਾ ਜਾਂਦਾ ਹੈ ਕਿ ਜੇ ਉਹਨੂੰ ਗੁੱਝੀ ਸੱਟ ਲੱਗੀ ਹੈ ਜਾਂ ਕਿੱਦਾਂ ਗੁੱਝੀ ਸੱਟ ਲੱਗੀ ਤਾਂ ਉਹਨੂੰ ਰੋਕਥਾਮ ਲਈ 'ਤੇ ਸਪਰੇ ਵਗੈਰਾ ਚੱਲਿਆ ਹੋਇਆ ਅੱਜ ਕੱਲ੍ਹ ਸਪਰੇ ਵਗੈਰਾ ਮਾਰ ਕੇ ਉਹਨੂੰ ਠੀਕ ਕੀਤਾ ਜਾਂਦਾ ਹੈ ਕਿ ਉਹਨੂੰ ਮਹਿਸੂਸ ਨਾ ਹੋਵੇ ਕਿ ਮੇਰੇ ਚੋਟ ਲੱਗੀ ਹੋਈ ਹੈ ਬਾਕੀ ਉਹਦਾ ਇਲਾਜ ਸਾਰਾ ਬਾਅਦ 'ਚ ਕੀਤਾ ਜਾਂਦਾ ਹੈ ਪੂਰੀ ਤਰ੍ਹਾਂ ਜਿਸ ਲਈ ਉਹਨੂੰ ਸਟੇਡੀਅਮ ਤੋਂ ਬਾਹਰ ਲਿਆ ਲੈ ਕੇ ਜਾਇਆ ਜਾਂਦਾ ਜੀ ਮੈਚ ਖਤਮ ਹੋ ਜਾਂਦਾ ਜਦੋਂ ਓਕੇ ਜੀ